ਰਾਸ਼ਟਰੀ ਪੱਧਰ 'ਤੇ ਫੋਟੋਗ੍ਰਾਫੀ ਦੇ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੀ ਸੰਸਥਾਵਾਂ ਹਨ ਜਿਵੇਂ ਕਿ ਨੈਸ਼ਨਲ ਇੰਸਟੀਟਿਊਟ ਔਫ ਫੋਟੋਗ੍ਰਾਫੀ ਐੱਨ ਆਈ ਐੱਫ ਟੀ ਦਿੱਲੀ ਐੱਮ ਟੀ ਸਕੂਲ ਆਫ ਕੰਮਿਊਨੀਕੇਸ਼ਨਜ਼ ਨਾਗਪੁਰ ਯੂਨੀਵਰਸਿਟੀ ਅਤੇ ਕੁਝ ਕੁ ਅੰਤਰਰਾਸ਼ਟਰੀ ਸੰਸਥਾਵਾਂ ਫੋਟੋਗ੍ਰਾਫੀ ਦੀ ਡਿਗਰੀ ਪ੍ਰਾਪਤ ਕਰਨ ਲਈ ਹਨ ਰੋਇਲ ਕੋਲਜ ਆਫ ਆਰਟ ਕੋਲੰਬੀਆ ਕੋਲਜ ਚਿਆਂਗੋ ਕੈਂਟ ਸਟੇਟ ਯੂਨੀਵਰਸਿਟੀ ਲਾਈਟ ਐਂਡ ਲਾਈਫ ਅਕੈਡਮੀ ਨੈਸ਼ਨਲ ਇੰਸਟੀਟਿਊਟ ਔਫ ਡਿਜਾਈਨ ਟੋਕਿਓ ਜ਼ੁਆਕੀ ਯੂਨੀਵਰਸਿਟੀ ਨੈਸ਼ਨਲ ਇੰਸਟੀਟਿਊਟ ਔਫ ਫੋਟੋਗ੍ਰਾਫੀ ਪੈਰਿਸ ਕਾਲਜ ਔਫ ਆਰਟ ਅਕੈਡਮੀ ਔਫ ਆਰਟ ਯੂਨੀਵਰਸਿਟੀ ਕ੍ਰੀਏਟਿਵ ਹੱਟ ਇੰਸਟੀਚਿਊਟ ਔਫ ਫੋਟੋਗ੍ਰਾਫੀ ਫੋਟੋਗ੍ਰਾਫੀ ਸਟੱਡੀਜ ਕੋਲਜ ਇਹ ਕੁਝ ਸੰਸਥਾਵਾਂ ਹਨ ਜਿੱਥੋਂ ਕਿ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿੱਚ ਫੋਟੋਗ੍ਰਾਫੀ ਦੇ ਵਿੱਚ ਡਿਗਰੀ ਪ੍ਰਾਪਤ ਕਰ ਸਕਦੇ ਹਾਂ